ਮੈਂ ਸ਼ਾਮਾਂ ਬਹੁਤ ਪੈ ਗਈਆਂ ਸੀ ਫਿਰ ਮੈਂ ਅਗਲੇ ਸਵੇਰ ਬਾਜ਼ਾਰ ਗਈ ਉੱਥੋਂ ਮੈਂ ਵਧੀਆ ਜਿਹੀ ਤਾਜ਼ੀ ਤਾਜ਼ੀ ਸੋਹਣੀ ਸੋਹਣੀ ਚਿੱਟੀ ਗੋਬੀ ਲੈ ਕੇ ਆਈ ਉਸ ਗੋਭੀ ਨੂੰ ਮੈਂ ਧੋਤਾ ਕੱਟਿਆ ਫਿਰ ਉਹਨੂੰ ਮੈਂ ਕਰ ਬਿਲੀਕਸ਼ ਕੀਤਾ ਬਿਲੀਕਸ਼ ਕਰਨ ਤੋਂ ਬਾਅਦ ਮੈਂ ਉਹਦੇ ਵਿੱਚ ਮਸਾਲੇ ਪਾਏ ਅਤੇ ਫਿਰ ਮੈਂ ਉਹਨੂੰ ਉਨ ਮ ਵੇਸਣ ਪਾਇਆ ਵੇਸਣ ਨੂੰ ਛਾਣਿਆ ਵੇਸਣ ਨੂੰ ਵੇਖਿਆ ਚੰਗੇ ਤਰੀਕੇ ਨਾਲ ਵੀ ਵੇਸਣ ਸਾਫ਼ ਹੋਵੇ ਵੇਸਣ ਵਿੱਚ ਪਾ ਕੇ ਵਿੱਚ ਫਿਰ ਮਨਚੂਰੀਅਨ ਦੇ ਪਕੌੜੇ ਬਣਾਏ ਮਨਚੂਰੀਅਨ ਦੇ ਪਕੌੜੇ ਛਾਣ ਕੇ ਫਿਰ ਮੈਂ ਲੋੜ ਦਾ ਜਿੰਨਾ ਮੈਨੂੰ ਲੋੜ ਸੀਗੀ ਉੱਨਾ ਮੈਂ ਤੇਲ ਰੱਖਿਆ ਬਾਕੀ ਮੈਂ ਸਾਈਡ 'ਤੇ ਕਰਤਾ ਉਸੇ ਤੇਲ ਦੇ ਵਿੱਚ ਫਿਰ ਮੈਂ ਪਿਆਜ਼ ਕੱਟੇ ਪਿਆਜ਼ ਇਕੱਲੇ ਇਕੱਲੇ ਕੱਟਾ ਪਿਆਜ਼ ਕੱਟਿਆ ਫਿਰ ਵਿੱਚ ਉਹਦੇ ਪਿਆਜ਼ ਦੀਆਂ ਭੁੱਕਾਂ ਕੱਟੀਆਂ ਮਿਰਚਾਂ ਕੱਟੀਆਂ ਫਿਰ ਉਸ ਤੋਂ ਬਾਅਦ ਮੈਂ ਟਮਾਟਰ ਕੱਟੇ ਫਿਰ ਮੈਂ ਉਹਦੇ ਵਿੱਚ ਸੌਸ ਪਾਈ ਸੋਇਆ ਸੌਸ ਪਾਈ ਇਹ ਸਿਰਕਾ ਪਾਇਆ ਫਿਰ ਉਹਨਾਂ ਨੂੰ ਹਾਫ ਥੋੜ੍ਹਾ ਅੱਧ ਕੱਚਾ ਜਿਹਾ ਰੱਖਿਆ ਉਹਦੇ ਵਿੱਚ ਹੀ ਮੈਂ ਉਵ ਉਹ ਵੀ ਪਾਇਆ ਬ ਸ਼ਿਮਲਾ ਮਿਰਚ ਵੀ ਪਾਈ ਸ਼ਿਮਲਾ ਮਿਰਚ ਵੀ ਮੈਂ ਸੋਹਣੀ ਸੋਹਣੀ ਹਰੀ ਹਰੀ ਦੇਖ ਕੇ ਲਿਆਉਂਦੀ ਸੀਗੀ ਕਿ ਵਧੀਆ ਰਹੇ ਮੈਂ ਉਹਨੂੰ ਅੱਧਾ ਕੱਚਾ ਜਾ ਰੱਖਿਆ ਕਿ ਉਹਦਾ ਫਲੇਵਰ ਉਹਦਾ ਟੇਸਟ ਵਧੀਆ ਆਵੇ ਉਹਦਾ ਸਵਾਦ ਵਧੀਆ ਹੋਵੇ ਉਹ ਸਾਰੇ ਨੂੰ ਤਿਆਰ ਕਰਕੇ ਫਿਰ ਮੈਂ ਉਹਦੇ ਵਿੱਚ ਸਪੈਸ਼ਲ ਮਸਾਲਾ ਐਡ ਕੀਤਾ ਮਨਚੂਰੀਅਨ ਮਸਾਲਾ ਮਨਚੂਰੀਅਨ ਮਸਾਲਾ ਪਾਣ ਤੋਂ ਬਾਅਦ ਫਿਰ ਮੈਂ ਮਨਚੂਰੀਅਨ ਪਾਇਆ ਫਿਰ ਉਹਨੂੰ ਮੈਂ ਥੋੜ੍ਹਾ ਜਿਹਾ ਹਲਕਾ ਥੋੜ੍ਹੀ ਜਿਹੀ ਹਲਕੀ ਜੀ ਧੀਮੀ ਆਂਚ ਦਿਖਾਈ ਉਹਨੂੰ ਜਦੋਂ ਉਹ ਥੋੜ੍ਹਾ ਹ ਹਦ ਅੱਧਾ ਹੋ ਗਿਆ ਫਰਾਏ ਹੋ ਗਿਆ ਪੱਕ ਗਿਆ ਫਿਰ ਮੈਂ ਉਹਨੂੰ ਗੈਸ ਨੂੰ ਬੰਦ ਕਰਤਾ ਫਿਰ ਮੈਂ ਆਪਣੇ ਸਾਰੇ ਪਰਿਵਾਰ ਨੂੰ ਖਵਾਇਆ ਮੇਰੇ ਸਾਰੇ ਪਰਿਵਾਰ ਨੇ ਖਾ ਕੇ ਸਭ ਬਹੁਤ ਖੁਸ਼ ਹੋਏ ਕਿ ਬਹੁਤ ਵਧੀਆ ਬਣਿਆ ਆ ਪਹਿਲੀ ਵਾਰ 'ਚ ਮੈਂ ਇੱਕ ਸਕੈੱਚ ਨੂੰ ਦੇਖ ਕੇ ਇੰਨੀ ਵਧੀਆ ਰੈਸਿਪੀ ਬਣਾਈ ਸਾਰੇ ਬਹੁਤ ਪ੍ਰਭਾਵਿਤ ਹੋਏ ਸਭ ਨੂੰ ਬਹੁਤ ਪਸੰਦ ਆਇਆ ਧੰਨਵਾਦ